ਟਕਨੋਲੋਜ਼ੀ ਨੇ ਸਾਡੇ ਜੀਵਨਸ਼ੈਲੀ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਹੈ ਪਹਿਲੇ ਜਮਾਨੇ ਵਿੱਚ ਜਿਸ ਤਰ੍ਹਾਂ ਘਰਾਂ ਵਿੱਚ ਡਾਕੀਆ ਡਾਕ ਲੈ ਕੇ ਆਉਂਦਾ ਸੀ ਹੁਣ ਟੈਕਨੋਲਜ਼ੀ ਨੇ ਉਸ ਨੂੰ ਈਮੇਲ ਰਾਹੀਂ ਸਾਡਾ ਜੀਵਨ ਵਿੱਚ ਕੁਛ ਵੀ ਸੰਦੇਹਾ ਸੰਦੇਸ਼ ਭੇਜਣਾ ਹੋਵੇ ਈਮੇਲ ਆਈ ਡੀ ਜਿਸ ਤਰ੍ਹਾਂ ਆਪਾਂ ਜੀਮੇਲ ਕਿਸ ਨੂੰ ਕਰ ਦਿੰਦੇ ਹਾਂ ਆਈ ਡੀ ਰਾਹੀਂ ਅਸੀਂ ਉਸ ਦੀ ਵਰਤੋਂ ਕਰਕੇ ਸੁਨੇਹਾ ਭੇਜ ਦਿੰਦੇ ਹਾਂ ਇਸੇ ਤਰ੍ਹਾਂ ਟੈਕਨੋਲੋਜੀ ਨੇ ਨਿਊਜ਼ ਪੇਪਰ ਜੋ ਸਾਡਾ ਘਰਾਂ ਵਿਚ ਸਭ ਤੋਂ ਪਹਿਲੇ ਮੋਰਨਿੰਗ ਟਾਈਮ ਬਜ਼ੁਰਗ ਸਾਡੇ ਸੀਨੀਅਰ ਨਿਊਜ਼ ਪੇਪਰ ਦੇ ਸ਼ੌਕੀਨ ਹੁੰਦੇ ਸੀ ਉਸ ਨੂੰ ਵੀ ਟੈਕਨੋਲਜੀ ਨੇ ਅਪਗ੍ਰੇਡ ਕੀਤਾ ਹੈ ਹੁਣ ਹਰ ਘਰ ਵਿੱਚ ਨਿਊਜ਼ ਚੈਨਲ ਟੈਕਨੋਲਜੀ ਦੇ ਟੈਕਨੋਲੋਜੀ ਦੇ ਕਾਰਨ ਨਿਊਜ਼ ਚੈਨਲ ਅਸੀਂ ਸੁਣ ਪਾ ਰਹੇ ਹਾਂ ਇਸ ਤਰ੍ਹਾਂ ਅਸੀਂ ਟਕਨੋਲਜੀ ਦੀ ਕਾਰਨ ਹੀ ਲਾਈਵ ਟੈਲੀਕਾਸਟ ਕ੍ਰਿਕਟ ਮੈਚ ਨਿਊਜ਼ ਚੈਨਲ ਲਾਈਵ ਦੇਖ ਸਕਦੇ ਹਾਂ ਟਕਨੋਲਜੀ ਦੀ ਦੇਣ ਹੋਣ ਦੇ ਨਾਲ ਹੀ ਨਿਊਜ਼ ਚੈਨਲ ਜਿਸ ਤਰ੍ਹਾਂ ਲਾਈਵ ਕੁਛ ਵੀ ਚੱਲ ਰਿਹਾ ਕ੍ਰਿਕਟ ਮੈ ਇੰ ਇਨਫੋਰਮੇਸ਼ਨ ਕੁਛ ਵੀ ਬ੍ਰੇਕਿੰਗ ਨਿਊਜ ਸਾਨੂੰ ਲਾਈਵ ਓਨ ਦੀ ਸਪੋਰਟ ਹੀ ਮਿਲ ਜਾਂਦੀ ਹੈ ਇਸ ਵਿੱਚ ਟੈਕਨੋਲਜੀ ਦਾ ਬਹੁਤ ਵੱਡਾ ਯੋਗਦਾਨ ਹੈ ਟੈਕਨੋਲਜੀ ਦੇ ਹੋਣ ਨਾਲ ਦੇਸ਼ ਨੇ ਵਰਲਡ ਨੇ ਬਹੁਤ ਸਾਰੀ ਤਰੱਕੀ ਦੀ ਕੀਤੀ ਹੈ ਸਾਡੇ ਸੈਟਲਾਈਟ ਸਪੇਸ ਸਟੇਸ਼ਨ ਸਾਰੇ ਟੈਕਨੋਲਜੀ ਦੇ ਕਾਰਨ ਹੀ ਟਿਕੇ ਹੋਏ ਨੇ ਇਸ ਤੋ ਇਲਾਵਾ ਜਿਹੜੇ ਅਸੀਂ ਨਿਊਜ਼ ਚੈਨਲ ਜਾਂ ਸਪੋਰਟਸ ਚੈਨਲ ਹੈ ਉਹ ਵੀ ਅਸੀਂ ਟੈਕਨੋਲਜੀ ਦੀ ਹੀ ਦੇਣ ਦੇ ਸਕਦੇ ਹਾਂ ਟੈਕਨੋਲਜੀ ਦੇ ਨਾਲ ਸਟੱਡੀ ਈਜ਼ੀ ਹੋ ਗਈ ਪੜ੍ਹਾਈ ਵਿੱਚ ਬਹੁਤ ਈਜ਼ੀ ਹੋ ਗਿਆ ਪਹਿਲੇ ਕਾਪੀਆਂ ਕਿਤਾਬਾਂ ਨਾਲ ਬੱਚੇ ਉਲਝੇ ਰਹਿੰਦੇ ਸੀ ਹੁਣ ਆਨਲਾਈਨ ਟੈਕਨੋਲਜੀ ਦੀ ਦੇਣ ਕਾਰਨ ਅਸੀਂ ਆਨਲਾਈਨ ਸਟੱਡੀ ਵੀ ਕਰ ਰਹੇ ਹਾਂ